ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ ਦੂਜਾ ਮੁੱਖ ਨਾਚ ਗਿੱਧਾ ਹੈ ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ ਨਾਚ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ ਲੰਮੀ ਰਖਾਲਨਾ ਅਤੇ ਕਰੜੀ ਮਿਹਨਤ ਨੂੰ ਸੁਨਹਿਰਾ ਫਲ ਲੱਗਿਆ ਵੇਖ ਕਿਸ ਦਾ ਦਿਲ ਨਹੀਂ ਨੱਚ ਉੱਠਦਾ ਮੁੱਢ ਵਿੱਚ ਇਹ ਨਾਚ ਫਲਾਂ ਦੀ ਉਪਜਾਊ ਸ਼ਕਤੀ ਵਧਾਉਣ ਲਈ ਕੀਤੀਆਂ ਰੀਤੀ ਰਸਮਾਂ ਸਮੇਂ ਖੁੱਲ੍ਹੇ ਖੇਤਾਂ ਵਿੱਚ ਨਜਿਆ ਜਾਂਦਾ ਸੀ ਪਰ ਅੱਜ ਇਸ ਦਾ ਵਿਸ਼ਾ ਇੱਕ ਅਲੱਗ ਪਾਸੇ ਜਾਈ ਜਾਂਦਾ ਪਿਆ ਹੈ ਵਰਤਮਾਨ ਦਸ਼ਾ ਵਿੱਚ ਪੰਜਾਬ ਦੇ ਵਿਹੜੇ 'ਚ ਹੁਣ ਭੰਗੜੇ ਦੀ ਧਮਾਲ ਇੰਨੀ ਨਹੀਂ ਪੈਂਦੀ ਹੁਣ ਨਾ ਛਾਲ ਛਬੀਲੇ ਗੱਬਰੂ ਲੱਭਦੇ ਨੇ ਅਤੇ ਨਾ ਹੀ ਜੇਬ ਭਾਰ ਝੱਲਦੀ ਹੈ ਜੋ ਪੰਜਾਬ ਕਦੇ ਖੁਦ ਨੱਚਦਾ ਸੀ ਉਸਦੇ ਪੱਬਾਂ ਹੇਠ ਜਰਖੇਜ਼ ਪਹੁ ਵੀ ਨਹੀਂ ਰਹੀ ਰਹਿੰਦੀ ਕਸਰ ਨਸ਼ਿਆਂ ਨੇ ਕੱਢ ਦਿੱਤੀ ਜੁੱਸੇ ਵਾਲੀ ਜਵਾਨੀ ਲੱਭਣੀ ਵੀ ਸੌਖੀ ਨਹੀਂ ਬਾਕੀ ਬਾਜ਼ਾਰ ਦੇ ਲਿਸ਼ਕ ਨੇ ਲੋਕ ਨਾਚ ਭੰਗੜੇ ਦੇ ਨੁਹਾਰ ਖੋਹ ਲਈ ਹੈ ਲੋਕ ਇਸਦੀ ਅਹਿਮੀਅਤ ਤੋਂ ਦੂਰ ਜਾਂਦੇ ਪਏ ਹਨ ਪਹਿਲਾਂ ਭੰਗੜੇ ਤੋਂ ਬਿਨਾਂ ਹੋਰ ਸਾਜ਼ ਜਿਵੇਂ ਪਕਤੀ ਅਲਗੋਜ਼ੇ ਸੱਪ ਕਾਟੋ ਆਦਿ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਇਹ ਚੀਜ਼ਾਂ ਅਲੋਪ ਹੋਈ ਜਾਂਦੀਆਂ ਹਨ ਹੌਲੀ ਹੌਲੀ ਤਾਲ ਤੇਜ਼ ਹੁੰਦਾ ਜਾਂਦੀ ਹੈ ਜਿਸ ਨਾਲ ਸਰੀਰ ਦੀਆਂ ਅਦਾਵਾਂ ਵੀ ਤੇਜ਼ ਹੁੰਦੀਆਂ ਜਾਂਦੀਆਂ ਸਨ ਪਰ ਹੁਣ ਉਹ ਜੋਸ਼ ਨਹੀਂ ਰਿਹਾ ਲੋਕਾਂ ਕੋਲ ਹੁਣ ਟਾਈਮ ਹੀ ਨਹੀਂ ਹੈ ਅਤੇ ਲੋਕ ਗਲਤ ਪਾਸੇ ਨਸ਼ਿਆਂ ਵਾਂਗ ਜਾ ਰਹੇ ਹਨ ਅਤੇ ਭੰਗੜੇ ਦੀ ਨੁਹਾਰ ਖੋਹ ਲਈ ਹੈ ਭੰਗੜਾ ਉਹ ਆਪਣੇ ਸਥਿਤੀ ਭੁੱਲਦਾ ਜਾਂਦਾ ਪਿਆ ਹੈ ਜਿਹੜਾ ਕਿ ਸਾਡੀ ਸੰਸਕ੍ਰਿਤੀ ਨਾਲ ਜੁੜਿਆ ਸੀ ਹੁਣ ਇਸ ਨੂੰ ਵੈਸਟਰਨ ਕਲਚਰ ਵੱਲ ਲਈ ਜਾਂਦਾ ਪਿਆ ਹੈ